ਖੇਤੀ ਅਤੇ ਪਸ਼ੂ ਪਾਲਣ ਦੇ ਵਿੱਚ ਖੇਤੀ ਟੈਕਨੋਲੋਜੀ ਨੇ ਬਹੁਤ ਵੱਡਾ ਸਹਾਰਾ ਪ੍ਰਦਾਨ ਕੀਤਾ ਹੈ ਜਿਸਦੇ ਵਿੱਚ ਸਾਨੂੰ ਖੇਤੀ ਦੇ ਵਿੱਚ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਜਿਵੇਂ ਅਸੀਂ ਮੱਝਾਂ ਨੂੰ ਕੱਖ ਲੈ ਕੇ ਆਉਣੇ ਹੋਣ ਮੱਝਾਂ ਨੂੰ ਪੱਠੇ ਵਗੈਰਾ ਵੱਢ ਕੇ ਲੈ ਕੇ ਆਉਂਦੇ ਹਾਂ ਤਾਂ ਉਹ ਸਾਰੇ ਅਸੀਂ ਟਰੈਕਟਰ ਦੇ ਉੱਤੇ ਲੱਦ ਕੇ ਲੈ ਕੇ ਆਉਂਦੇ ਹਾਂ ਟਰੈਕਟਰ ਦਾ ਬਹੁਤ ਜ਼ਿਆਦਾ ਫਾਇਦਾ ਏ ਜਿਹੜੀ ਟੈਕਨੋਲੋਜੀ ਆਈ ਹੈ ਇਸ ਦੇ ਨਾਲ਼ ਬਹੁਤ ਸਾਰੇ ਲੋਕਾਂ ਨੂੰ ਸਹਾਰਾ ਮਿਲਿਆ ਹੈ ਪਿਛਲੇ ਸਮਿਆਂ ਦੇ ਵਿੱਚ ਜਦੋਂ ਇਹ ਟੈਕਨੋਲੋਜੀ ਨਹੀਂ ਸੀ ਉਸ ਟਾਈਮ ਦੇ ਉੱਤੇ ਲੋਕ ਜਾਨਵਰਾਂ ਦੇ ਉੱਤੇ ਲੈ ਕੇ ਜਾਂਦੇ ਸਨ ਜਿਸ ਦੇ ਕਰਕੇ ਇਹ ਚੀਜ਼ਾਂ ਜਾਨਵਰਾਂ ਦੇ ਉੱਤੇ ਇੱਕ ਤਰ੍ਹਾਂ ਦਾ ਧੱਕਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜਾਨਵਰਾਂ ਦੇ ਉੱਤੇ ਜ਼ਿਆਦਾ ਵਜ਼ਨ ਚੱਕਿਆ ਜਾਂਦਾ ਸੀ ਪਰ ਇਹ ਚੀਜ਼ਾਂ ਦੇ ਆਉਣ ਦੇ ਨਾਲ਼ ਜਾਨਵਰਾਂ ਨੂੰ ਸੁਖਾਲ਼ਾ ਹੋ ਗਿਆ ਹੈ ਉਹ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ਼ ਜੀਉਂਦੇ ਹਨ ਅਤੇ ਦੂਸਰੇ ਨੰਬਰ 'ਤੇ ਇਹ ਵੀ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਮੱਕੀ ਵੱਢੀ ਜਾਂਦੀ ਹੈ ਮੱਕੀ ਵੱਢਣ ਦੇ ਲਈ ਵੀ ਇਹੋ ਜਿਹੀਆਂ ਮਸ਼ੀਨਾਂ ਆ ਗਈਆਂ ਜਿਹੜੀ ਜਿਸ ਦੇ ਨਾਲ਼ ਇਨਸਾਨ ਅੱਜ ਕੱਲ੍ਹ ਨਹੀਂ ਵੱਢਦਾ ਉਹ ਮਸ਼ੀਨ ਦੇ ਥਰੂ ਹੀ ਵੱਢੀ ਜਾਂਦੀ ਹੈ ਅਤੇ ਉਹ ਉਸ ਚੀਜ਼ ਦਾ ਅਚਾਰ ਤਿਆਰ ਕਰਿਆ ਜਾਂਦਾ ਅਚਾਰ ਤਿਆਰ ਕਰਕੇ ਉਹ ਜਾਨਵਰਾਂ ਨੂੰ ਘਰ ਹੀ ਪਾਇਆ ਜਾਂਦਾ ਹੈ ਜਿਸ ਦੇ ਨਾਲ਼ ਕਈ ਚੀਜ਼ਾਂ ਦੀ ਬਰਕਤ ਪੈਂਦੀ ਹੈ ਅਤੇ ਆਪਣੀ ਤੂੜੀ ਦੀ ਵੀ ਬਰਕਤ ਪੈਂਦੀ ਹੈ ਅਚਾਰ ਤਿਆਰ ਕਰਨ ਦੇ ਨਾਲ਼ ਅਤੇ ਹੋਰ ਵੀ ਖੇਤੀਬਾੜੀ ਦੇ ਵਿੱਚ ਟੈਕਨੋਲੋਜੀ ਇਹੋ ਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਜਿਵੇਂ ਕਿ ਲੋਕ ਜੀਰੀਆਂ ਪਹਿਲਾਂ ਕਣਕਾਂ ਪਹਿਲਾਂ ਹੱਥਾਂ ਦੇ ਨਾਲ਼ ਵੱਢਦੇ ਹੁੰਦੇ ਸੀਗੇ ਅੱਜ ਦੀ ਰੇ ਅੱਜ ਦੇ ਦਿਨਾਂ ਦੇ ਵਿੱਚ ਉਹ ਚੀਜ਼ਾਂ ਮਸ਼ੀਨਾਂ ਦੇ ਨਾਲ਼ ਕੰਪਾਈਨਾਂ ਦੇ ਨਾਲ਼ ਵੱਢੀਆਂ ਜਾਂਦੀਆਂ ਨੇ ਪਹਿਲਾਂ ਕਈ ਕਈ ਦਿਨ ਲੋਕਾਂ ਨੂੰ ਲੱਗ ਜਾਂਦੇ ਸੀਗੇ ਪਰ ਹੁਣ ਉਹ ਮਸ਼ੀਨਾਂ ਘੰਟਿਆਂ ਦੇ ਵਿੱਚ ਹੀ ਕੰਮ ਨਿਬੇੜ ਕੇ ਲੋਕਾਂ ਨੂੰ ਫਰੀ ਕਰ ਦਿੰਦੀ ਹੈ ਜਿਸ ਦੇ ਨਾਲ਼ ਲੋਕਾਂ ਨੂੰ ਉਤਪਾਦਨ ਵੀ ਚੰਗਾ ਹੁੰਦਾ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ